ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਵੇਂ ਕਿ ਹਰ ਕਿਸੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕੰਮ ਕਰਨਾ ਅਤੇ ਆਪਣਾ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ ਨਾਲ ਜਿਵੇਂ ਜਿਵੇਂ ਹੁਣ ਮੇਰੀ ਗ੍ਰੈਜੂਏਸ਼ਨ ਵੀ ਕੰਪਲੀਟ ਹੋ ਗਈ ਹੈ ਅਤੇ ਮੈਨੂੰ ਪੜ੍ਹਾਈ ਦਾ ਸ਼ੌਕ ਤਾਂ ਪਹਿਲਾਂ ਤੋਂ ਹੀ ਬਹੁਤ ਸੀ ਪਰ ਨਾਲ ਨਾਲ ਮੈਨੂੰ ਸਿਲਾਈ ਕਢਾਈ ਦਾ ਸ਼ੌਕ ਵੀ ਸੀ ਹੁਣ ਮੈਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਿਲਾਈ ਕਢਾਈ ਤਾਂ ਕਰਦੀ ਹੀ ਹਾਂ ਅਤੇ ਉਸ ਦੇ ਨਾਲ ਨਾਲ ਮੈਂ ਕੰਪਿਊਟਰ ਦਾ ਕੋਰਸ ਵੀ ਕੀਤਾ ਹੈ ਅਤੇ ਹੁਣ ਮੈਂ ਇਹ ਸੋਚ ਰਹੀ ਹਾਂ ਕਿ ਬੱਚਿਆਂ ਨੂੰ ਬੇਸਿਕ ਆਫ ਕੰਪਿਊਟਰ ਦੀ ਨੌਲੇਜ ਦੇਵਾਂ ਉਹ ਵੀ ਘੱਟ ਦਾਮਾ 'ਚ ਧੰਨਵਾਦ